ਮੈਂ ਹੇਠ ਲਿਖਾ ਮੁਹਾਵਰਾਂ ਦੀ ਵਰਤੋਂ ਕਰਦਾ ਹਾਂ ਜਿਵੇਂ ਕਿ ਚੜ੍ਹਦੀ ਕਲਾ ਵਿੱਚ ਰਹਿਣਾ ਬੇੜਾ ਗਰਕ ਹੋਣਾ ਉੱਲੂ ਬਣਾਉਣਾ ਦਿਨ ਰਾਤ ਇੱਕ ਕਰਨਾ ਇੱਕ ਚੁੱਪ ਸੌ ਸੁੱਖ ਆਪ ਭਲਾ ਜਗ ਭਲਾ ਵਾਹ ਲਾਉਣੀ ਥਾਪੀ ਦੇਣਾ ਕਰਮਾਂ ਨੂੰ ਰੌਣਾ ਗੱਲਾਂ ਵਿੱਚ ਆਉਣਾ ਦਿਮਾਗ ਖਾਣਾ